ਸਤਿ ਸ਼੍ਰੀ ਅਕਾਲ ਮੈਂ ਰਮਨਪ੍ਰੀਤ ਕੌਰ ਬੋਲ ਰਹੀ ਹਾਂ ਕੀ ਮੈਂ ਹੈਪੀ ਬਾਈਟਸ ਦੇ ਮੈਨੇਜਰ ਨਾਲ਼ ਗੱਲ ਕਰ ਸਕਦੀ ਹਾਂ ਵੈਸੇ ਤਾਂ ਮੈਂ ਇੱਥੋਂ ਦੀ ਰੈਗੂਲਰ ਕਸਟਮਰ ਹਾਂ ਪਰ ਅੱਜ ਮੈਂ ਕੁਝ ਅਲੱਗ ਅਜ਼ਮਾਉਣਾ ਚਾਹੁੰਦੀ ਹਾਂ ਮੇਰੇ ਘਰ ਬਹੁਤ ਹੀ ਮਹਿਮਾਨ ਆਏ ਹੋਏ ਹਨ ਅਤੇ ਮੈਂ ਉਹਨਾਂ ਨੂੰ ਆਪਣੇ ਪਾਸ ਹੋਣ ਦੀ ਖੁਸ਼ੀ ਵਿੱਚ ਪਾਰਟੀ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੇ ਤੋਂ ਕੁਝ ਚਾਈਨਿਸ ਫੂਡ ਬਾਰੇ ਪਤਾ ਕਰਨਾ ਚਾਹੁੰਦੀ ਹਾਂ ਅਤੇ ਇਸ ਤੋਂ ਇਲਾਵਾ ਮੈਂ ਪੰਜਾਬੀ ਖਾ ਭੋਜਨ ਬਾਰੇ ਵੀ ਪੁੱਛਣਾ ਚਾਹੁੰਦੀ ਹਾਂ ਕੀ ਤੁਹਾਡੇ ਕੋਲ਼ ਕੁਝ ਸਪੈਸ਼ਲ ਹੈ ਅਗਰ ਤੁਹਾਡੇ ਕੋਲ਼ ਗੂਗਲ ਪੇ ਦੀ ਸਹੂਲਤ ਹੈ ਤਾਂ ਤੁਸੀਂ ਮੈਨੂੰ ਆਪਣਾ ਬਾਰਕੋਡ ਵੱਟਸਐਪ 'ਤੇ ਸ਼ੇਅਰ ਕਰ ਸਕਦੇ ਹੋ ਧੰਨਵਾਦ